ਮੈਂ ਆਰਮੀ ਐਕਸ ਸਰਵਿਸਮੈਨ ਹਾਂ ਮੈਨੂੰ ਨਹੀਂ ਲਗਦਾ ਕਿ ਔਰਤਾਂ ਦਾ ਹੀ ਕੰਮ ਹੈ ਕਿ ਖਾਣਾ ਬਣਾਉਣਾ ਲੇਕਿਨ ਮੈਂ ਮਰਦ ਹੋਣ ਦੇ ਨਾਤੇ ਬਾਹਰ ਆਰਮੀ 'ਚ ਵੀ ਅਤੇ ਜਦੋਂ ਦਾ ਮੈਂ ਆਪਣੇ ਘਰ ਆਇਆ ਹਾਂ ਅਤੇ ਮੈਂ ਆਪਣਾ ਖਾਣਾ ਆਪ ਬਣਾ ਕੇ ਖਾ ਸਕਦਾ ਹਾਂ ਮੰਨ ਲਵੋ ਕਿਸੇ ਦਿਨ ਇਸ ਤਰ੍ਹਾਂ ਦਾ ਹੋਵੇ ਕਿ ਔਰਤ ਘਰ ਦੇ ਵਿੱਚ ਨਹੀਂ ਹੈ ਤਾਂ ਮੈਂ ਖ਼ੁਦ ਖਾਣਾ ਸਬਜ਼ੀ ਚਾਵਲ ਚਪਾਤੀ ਬਣਾ ਕੇ ਆਪਣੀ ਆਪ ਖਾ ਸਕਦਾ ਅਤੇ ਆਪਣੇ ਬੱਚਿਆਂ ਨੂੰ ਖਵਾ ਸਕਦਾ ਹਾਂ ਅਤੇ ਇਸ ਤਰ੍ਹਾਂ ਐਗਜ਼ੈਮਪਲ ਦੇ ਤੌਰ ਪਰ ਜੋ ਲੋਕ ਅੱਜ ਕੱਲ੍ਹ ਦੇ ਕਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਰਹੇ ਹਨ ਉਹ ਵੀ ਬਾਹਰਲੀਆਂ ਮੁਲਕਾਂ ਵਿੱਚ ਜਾ ਕੇ ਆਪਣਾ ਖਾਣਾ ਆਪ ਹੀ ਤਿਆਰ ਕਰਦੇ ਹਨ ਇਸ ਲਈ ਔਰਤ ਦਾ ਕੰਮ ਹੀ ਨਹੀਂ ਖਾਣਾ ਬਣਾਉਣਾ ਮਰਦ ਦਾ ਕੰਮ ਵੀ ਹੈ ਖਾਣਾ ਬਣਾਉਣਾ